ਮਨੁੱਖ ਅਪ ਹਮੇਸ਼ਾ ਹੀ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ ਕਿਉਂ ਨਹੀਂ ਚਾਹੇਗਾ ਉਹ ਜੁੜਨਾ ਚਾਹੁੰਦਾ ਹੈ ਸਭ ਤੋਂ ਵੱਡੀ ਜੜ੍ਹ ਤਾਂ ਉਹਦੇ ਮਾਂ ਪਿਓ ਹੁੰਦੇ ਨੇ ਜਿਹਨੂੰ ਉਹ ਕਦੀ ਵੀ ਭੁਲਾਨਾ ਨਹੀਂ ਚਾਹੁੰਦਾ ਅਤੇ ਉਸ ਤੋਂ ਵੱਡੀ ਜੜ੍ਹ ਹੁੰਦੇ ਨੇ ਉਹਦੇ ਭੈਣ ਭਰਾ ਉਹਦੇ ਖੂਨ ਦੇ ਰਿਸ਼ਤੇ ਕਈ ਖੂਨ ਦੇ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਨਾ ਉਹ ਸੋਣ ਦਿੰਦੇ ਆ ਨਾ ਜਾਗਣ ਦਿੰਦੇ ਆ ਨਾ ਰੋਣ ਦਿੰਦੇ ਆ ਨਾ ਹੱਸਣ ਦਿੰਦੇ ਹੈ ਅਤੇ ਜਿਹੜੇ ਉਹਨਾਂ ਦੇ ਦੁੱਖ ਹੈ ਉਹ ਸਾਨੂੰ ਅੰਦਰੋਂ ਅੰਦਰੀ ਹੀ ਮਾਰ ਦਿੰਦੇ ਨੇ ਮਾਂ ਪਿਓ ਦਾ ਹੋਣਾ ਉਹ ਸਾਡੇ ਵਾਸਤੇ ਬਹੁਤ ਵੱਡੀ ਚੀਜ਼ ਹੈ ਅਤੇ ਮਾਂ ਪਿਓ ਦਾ ਨਾ ਹੋਣਾ ਉਹ ਸਾਡੀ ਜ਼ਿੰਦਗੀ 'ਚ ਬਹੁਤ ਕਮੀ ਹੈ ਬਹੁ ਬਹੁਤ ਜ਼ਿਆਦਾ ਕਮੀ ਪੇਸ਼ ਕਰਦਾ ਹੈ ਉਹਨਾ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਮਾਂ ਪਿਓ ਦੇ ਨਾ ਹੋਣ ਦੇ ਨਾਲ ਇੱਕ ਬੱਚਾ ਜਾਂ ਇੱਕ ਔਲਾਦ ਦੀ ਜੜ੍ਹ ਹੀ ਟੁੱਟ ਜਾਂਦੀ ਹੈ ਜਿਹਨੂੰ ਟਾਹਣੀ ਨੂੰ ਖਲੋਣਾ ਖਲਾਰਨਾ ਬਹੁਤ ਹੀ ਔਖਾ ਕੰਮ ਹੈ ਪਰ ਚਲੋ ਜਦੋਂ ਮੰਨ ਲਓ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਉਹਦਾ ਤਾਂ ਚਲੋ ਅੱਗੇ ਪਰਿਵਾਰ ਮਿਲ ਜਾਂਦਾ ਪਰ ਮੁੰਡੇ ਨੂੰ ਆਪਣੇ ਮਾਂ ਪਿਓ ਦੀ ਕਮੀ ਹਮੇਸ਼ਾ ਹੀ ਰਹਿੰਦੀ ਹੈ ਜਾਂ ਮਾਂ ਹੋਵੇ ਜਾਂ ਪਿਓ ਹੋਵੇ ਦੋਨੋਂ ਹੀ ਹੋਣੇ ਬਹੁਤ ਜ਼ਰੂਰੀ ਨੇ ਕਿਉਂਕਿ ਘਰ ਦੇ ਵਿੱਚ ਹੀ ਖੁਸ਼ ਖੁਸ਼ਹਾਲੀ ਦਾ ਮਾਹੌਲ ਬਣਿਆ ਰਹਿੰਦਾ ਹੈ ਬੱਚਿਆਂ ਨੂੰ ਵੀ ਆਪਣੇ ਮਾਂ ਪਿਓ ਹਮੇਸ਼ਾ ਹੀ ਦਿਖਣੇ ਚਾਹੀਦੇ ਹਨ ਜਦੋਂ ਉਹ ਜੜ੍ਹਾ ਟੁੱਟ ਜਾਂਦੀਆਂ ਹਨ ਅਤੇ ਮਨ ਲਓ ਕਿ ਜਿਵੇਂ ਇਨਸਾਨ ਦੀਆਂ ਦੋ ਬਾਹਾਂ ਹੀ ਟੁੱਟ ਗਈਆਂ ਉਹਨਾਂ ਬਿਨਾ ਖਲੋਣਾ ਜਾਂ ਕੋਈ ਵੀ ਕੰਮ ਕਰਨਾ ਕਦਮ ਕਦਮ 'ਤੇ ਆਪਣੇ ਮਾਂ ਪਿਓ ਤਾਂ ਹਮੇਸ਼ਾ ਹੀ ਯਾਦ ਆਉਂਦੇ ਨੇ ਕੋਈ ਦਿਨ ਇਹੋ ਜਿਹਾ ਨਹੀਂ ਹੁੰਦਾ ਸਾਡੀਆਂ ਅਸਲ ਜੜ੍ਹਾਂ ਜਿਹੜੀਆਂ ਸਾਡੇ ਮਾਂ ਪਿਓ ਸਾਡੇ ਖੂਨ ਦੇ ਰਿਸ਼ਤੇ ਸਾਡੇ ਭੈਣ ਭਰਾ ਜਿਨ੍ਹਾਂ ਨਾਲ ਅਸੀਂ ਬਹੁਤ ਪਿਆਰ ਕਰਦੇ ਹਾਂ ਜਾਂ ਸਾਡਾ ਆਦਮੀ ਜਨਾਨੀ ਦਾ ਇਹ ਰਿਸ਼ਤਾ ਇਹ ਪੱਕੀਆਂ ਜੜ੍ਹਾਂ ਨੇ